ਇੱਕ ਲੱਖ ਨੜਿਨਵੇਂ ਹਜ਼ਾਰ ਨੌ ਸੌ ਨੱਬੇ ਦੋ ਲੱਖ ਛਿਆਹਠ ਹਜ਼ਾਰ ਤਿੰਨ ਸੌ ਅਠਾਸੀ ਤਿੰਨ ਲੱਖ ਛਿਆਨਵੇਂ ਹਜ਼ਾਰ ਛੇ ਸੌ ਪਚਾਨਵੇਂ ਸੱਤ ਲੱਖ ਨੜਿਨਵੇਂ ਹਜ਼ਾਰ ਨੌ ਸੌ ਨੜਿਨਵੇਂ ਅੱਠ ਲੱਖ ਤੇਰ੍ਹਾਂ ਹਜ਼ਾਰ ਇੱਕ ਸੌ ਨੌ